ਪੰਜਾਬੀ ਲੋਕ ਆਪਣੀ ਪਛਾਣ ਦਿਖਾਉਣ ਲਈ ਆਪਣੀ ਮਾਂ ਬੋਲੀ ਦਾ ਹੀ ਜ਼ਿਆਦਾ ਪ੍ਰਯੋਗ ਕਰਦੇ ਹਨ ਅਤੇ ਗਾਣੇ ਵਗੈਰਾ ਵੀ ਇਸੀ ਭਾਸ਼ਾ ਵਿੱਚ ਸੁਣਦੇ ਹਨ